ਚਿੱਤਰਕਾਰੀ ਕਰਦੇ ਸਮੇਂ ਮੈਂ ਕੈਮਲ ਦੇ ਰੰਗ ਅਤੇ ਬਰੱਸ਼ ਖਰੀਦਣਾ ਪਸੰਦ ਕਰਦਾ ਹਾਂ ਮੈਨੂੰ ਕੈਮਲ ਦੇ ਰੰਗ ਪੈਨਸਿਲਾਂ ਬਰੱਸ਼ ਅਤੇ ਵਾਟਰ ਕਲਰ ਖਰੀਦਣਾ ਪਸੰਦ ਹੈ ਮੈਂ ਇਹ ਸਾਰੀ ਸਟੇਸ਼ਨਰੀ ਆਪਣੇ ਘਰ ਦੇ ਨੇੜੇ ਸ਼ੌਪਿੰਗ ਕੰਪਲੈਕਸ ਤੋਂ ਖਰੀਦਦਾ ਹਾਂ ਹਾਂਜੀ ਮੈਨੂੰ ਲੱਗਦਾ ਹੈ ਕਿ ਕਲਾ ਦੀ ਸਟੇਸ਼ਨਰੀ ਮਹਿੰਗੀ ਹੁੰਦੀ ਜਾ ਰਹੀ ਹੈ ਸੋ ਜੇਕਰ ਸਾਨੂੰ ਕਲਾ ਨੂੰ ਅੱਗੇ ਵਧਾਉਣਾ ਹੈ ਜਾਂ ਕਲਾਕਾਰਾਂ ਨੂੰ ਪ੍ਰੋਤਸਾਹਿਤ ਕਰਨਾ ਹੈ ਤਾਂ ਕਲਾ ਦੀ ਸਪਲਾਈ ਸਸਤੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਕਲਾਕਾਰ ਬਣਨ